ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਹਾਂਜੀ ਦੱਸੋ ਹਾਂਜੀ ਠੀਕ ਹੈ ਜੀ ਸਰ ਤੁਸੀਂ ਕਿੰਨੇ ਦਿਨ ਲਗਾਉਣੇ ਹੈ ਠੀਕ ਹੈ ਜੀ ਚਾਰ ਦਿਨਾਂ ਦਾ ਤੁਹਾਡਾ ਸਰ ਆ ਜਾਵੇਗਾ ਖਰਚਾ ਪੱਚੀ ਕੁ ਹਜ਼ਾਰ ਆ ਜੂੰਗਾ ਗੁਰਦੁਆਰਾ ਸਾਹਿਬ ਤੋਂ ਲੈ ਕੇ ਰਹਿਣ ਦਾ ਸਾਰਾ ਖਾਣ ਪੀਣ ਦਾ ਸਾਰਾ ਪ੍ਰਬੰਧ ਹੋਵੇਗਾ ਇਹਦੇ ਵਿੱਚ ਹਾਂਜੀ ਹਾਂਜੀ ਹਾਂਜੀ ਗੱਡੀ ਦਾ ਗੱਡੀ ਵੀ ਹੋਵੇਗੀ ਸਾਰਾ ਕੁਝ ਹੋਵੇਗਾ ਰਹਿਣ ਰਹਿਣ ਦਾ ਵੀ ਹੋਵੇਗਾ ਹੋਟਲ ਵਗੈਰਾ ਦਾ ਸਾਰਾ ਖ਼ਰਚਾ ਵਿੱਚ ਹੀ ਹਾਂਜੀ ਹਾਂਜੀ ਹਾਂਜੀ ਕੋਈ ਨਾ ਜੀ ਕਰ ਦੂੰਗੇ ਜਦੋਂ ਤੁਸੀਂ ਆਉਂਗੇ ਨਾ ਸਾਡੇ ਕੋਲ ਫੇਰ ਕਰ ਦੂੰਗੇ ਥੋੜ੍ਹਾ ਬਹੁਤ ਕਰ ਦੂੰਗੇ ਲੈੱਸ ਤੁਸੀਂ ਆ ਜਾਇਉ ਜਦੋਂ ਮਰਜ਼ੀ ਸ਼ਾਮ ਪੰਜ ਵਜੇ ਤੋਂ ਪਹਿਲਾਂ ਪਹਿਲਾਂ ਠੀਕ ਹੈ ਠੀਕ ਹੈ ਜੀ ਉਕੇ